ਅਸੀਂ ਇੱਕ ਵੱਡੀ ਚੜ੍ਹਾਈ ਵਾਲੇ ਦਿਨ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰੀ ਕਰਦੇ ਹਾਂ ਕਿ ਵੀ ਜਦੋਂ ਅਸੀਂ ਚੜ੍ਹਾਈ ਸਟਾਰਟ ਕਰਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਇੱਕ ਦੂਜੇ ਜਦੋਂ ਚੜ੍ਹਾਈ ਵਾਪਿਸ ਪੂਰੀ ਕਰਕੇ ਨੀਚੇ ਆ ਰਹੇ ਹੁੰਦੇ ਹਨ ਲੋਕ ਉਹਨਾਂ ਤੋਂ ਮੇਜਰਮੈਂਟ ਮੇਅਰਮੈਂਟ ਐਸਟੀਮੇਟ ਲੱਗ ਜਾਂਦਾ ਹੈ ਵੀ ਇੰਨੀ ਕਿਲੋਮੀਟਰ ਚੜ੍ਹਾਈ ਹੈ ਅਤੇ ਉਸ ਦੇ ਮੁਤਾਬਿਕ ਅਸੀਂ ਆਪਣੇ ਮਾਨਸਿਕ ਨੂੰ ਮਨ ਨੂੰ ਸੈਟ ਕਰਦੇ ਹਾਂ ਵੀ ਹੌਲੀ ਹੌਲੀ ਚਲਾ ਜਾ ਚੜਿਆ ਜਾ ਚੜਿਆ ਜਾ ਧੀਮੀ ਗਤੀ ਨਾਲ ਚੜਿਆ ਜਾ ਸਰੀਰਕ ਦੇ ਸਾਹ ਕਿਰਿਆ ਨੂੰ ਤੇਜ਼ ਕਰਦੇ ਹੋਏ ਹੌਲੀ ਹੌਲੀ ਹੌਲੀ ਹੌਲੀ ਲੰਬੇ ਸਾਹ ਲੈਂਦੇ ਹੋਏ ਦਮ ਲੈਂਦੇ ਹੋਏ ਹੌਲੀ ਹੌਲੀ ਅਸੀਂ ਚੜ੍ਹਾਈ ਚੜ੍ਹਦੇ ਜਾਂਦੇ ਹਾਂ ਅਤੇ ਕੁਝ ਮਨ ਦੇ ਵਿੱਚ ਸੋਚਦੇ ਜਾਂਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਹਾਂ ਜਾਂ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਜਾਂਦੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਆਪਣੇ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਥੋੜ੍ਹਾ ਜਿਹਾ ਕਾਮਯਾਬ ਰਹਿੰਦੇ ਹਾਂ ਅਤੇ ਸਰੀਰਿਕ ਤੌਰ 'ਤੇ ਕਾਮਯਾਬ ਰਹਿਣ ਲਈ ਅਸੀਂ ਚੜ੍ਹਾਈ ਕਰਦੇ ਸਮੇਂ ਹਲਕਾ ਭੋਜਨ ਖਾਈਦਾ ਅਤੇ ਪਾਣੀ ਪੀਈਦਾ ਅਤੇ ਜਾਂ ਆਪਣਾ ਗੁਲੋਕੋਂਡੀ ਦੀ ਵਰਤੋਂ ਕਰੀ ਕਰਦੇ ਹਾਂ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਹੌਲੀ ਹੌਲੀ ਅਸੀਂ ਚੜ੍ਹਾਈ ਚੜ੍ਹਦੇ ਜਾਂਦੇ ਹਾਂ ਅਤੇ ਚੜ੍ਹਾਈ ਚੜ੍ਹਦੇ ਸਮੇਂ ਅੱਧਾ ਘੰਟਾ ਚੜ੍ਹਾਈ ਕਰਨ ਲਈ ਉਸ ਤੋਂ ਬਾਅਦ ਦਸ ਵੀਹ ਮਿੰਟਾਂ ਦੀ ਰੈਸਟ ਵਿੱਚ ਲੈ ਲੈਂਦੇ ਹਾਂ ਤਾਂ ਕਿ ਸਰੀਰ ਦੀ ਥੋੜ੍ਹੀ ਜਿਹੀ ਰਿਕਵਰੀ ਹੋ ਜਾਵੇ ਅਤੇ ਗੁਲੋਕੋਂਡੀ ਦੀ ਵਰਤੋਂ ਕਰਕੇ ਅਸੀਂ ਦੁਬਾਰਾ ਫਿਰ ਸਟਾਰਟ ਕਰਦੇ ਹਾਂ ਇਸ ਵਿੱਚ ਅਰਾਮ ਅਵਸਥਾ ਵੀ ਜ਼ਰੂਰੀ ਹੈ ਨਹੀਂ ਤਾਂ ਲਗਾਤਾਰ ਚੜ੍ਹਾਈ ਕਰਨ ਦੇ ਸਮੇਂ ਸਰੀਰ ਦੇ ਵਿੱਚ ਥਕਾਵਟ ਆਉਣ ਲੱਗ ਜਾਂਦੀ ਹੈ